ਹੈਲੋ ਨਮਸਕਾਰ ਜੀ ਹਾਂਜੀ ਸਰ ਅਗਰ ਇਹਦੇ ਆਰਮੀ ਸਕੂਲ ਤਿੱਬੜੀ ਕੈਂਟ ਉਹਦੇ ਨਾਲ ਹੀ ਕੇ ਵੀ ਵੀ ਹੈ ਕੇ ਵੀ ਕੇਂਦਰੀ ਵਿਦਿਆਲਿਆ ਦੋਨੋਂ ਵਧੀਆ ਅਤੇ ਫਿਰ ਜੇ ਇਸ ਤੋਂ ਵੀ ਵਧੀਆ ਤਾਂ ਉਹ ਨਇਆ ਹੈ ਜਾਂ ਦੋ ਤਿੰਨ ਸਾਲ ਹੋ ਗਏ ਹੈ ਸ਼ਾਇਦ ਤਿੰਨ ਸਾਲ ਹੋ ਗਏ ਖੁੱਲ੍ਹੇ ਇੰਟਰਨੈਸ਼ਨਲ ਸਕੂਲ ਹਾਂਜੀ ਅਤੇ ਹੈ ਤਾਂ ਉਹ ਬਹੁਤ ਵਧੀਆ ਹੈ ਥੋੜ੍ਹਾ ਮਹਿੰਗਾ ਕੋਸਟਲੀ ਹੈ ਉਹਦੀ ਫੀਸ ਫੂਸ ਵਗੈਰਾ ਪਰ ਫਸਿਲਟੀ ਵੀ ਕਾਫੀ ਅੱਛੀ ਹੈ ਬੱਚਿਆਂ ਨੂੰ ਇਸ ਚੀਜ਼ ਦੀਆਂ ਬੱ ਬੱਸਾਂ ਉਹਨਾਂ ਦੀਆਂ ਆਉਣ ਜਾਣ ਦੀਆਂ ਪੂਰਾ ਸਕੂਲ ਏ ਸੀ ਆ ਕਲਾਸਰੂਮ ਵਗੈਰਾ ਵੀ ਅਤੇ ਪਲੇ ਵੀ ਮਤਲਬ ਖੇਡਾਂ 'ਚ ਵੀ ਬਹੁਤ ਵਧੀਆ ਬੱਚੇ ਨੂੰ ਸਿੱਖਾਉਂਦੇ ਆ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਦੇ ਸਾਰੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਅਤੇ ਕਲਾਸਰੂਮ ਵੀ ਬਹੁਤ ਵਧੀਆ ਹੈ ਆਰਮੀ ਸਕੂਲ ਵੀ ਵਧੀਆ ਡੇਲੀ ਬੋਰਡ 'ਤੇ ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ ਟੀਚਰ ਵੀ ਵਧੀਆ ਹੈ ਠੀਕ ਹੈ ਜੀ ਬਾਕੀ ਸਰ ਇੱਥੇ ਤਾਂ ਲੋਕਲ ਉਹਨਾਂ ਨੇ ਖੁਦ ਹੀ ਲਵਾਏ ਹੋਏ ਹੈ ਪਰ ਫਿਰ ਵੀ ਸਲੈਕਟਡ ਹੀ ਹੁੰਦੇ ਆ ਉਹ ਇੰਟਰਵਿਊ ਵਗੈਰਾ ਲੈ ਕੇ

ਕੇ ਵੀ ਦਾ ਤਾਂ ਸਰ ਹੋਰ ਵੀ ਵਧੀਆ ਉਹ ਤਾਂ ਉੱਥੇ ਤਾਂ ਪੱਕੇ ਟੀਚਰ ਲੱਗੇ ਨਾ ਗੌਰਮੈਂਟ ਜੋਬ ਵਾਲੇ ਹਾਂਜੀ ਸਰ ਹੋਰ